ਮੇਰੀ ਸਭ ਤੋਂ ਸੁੰਦਰ ਯਾਤਰਾ ਜਗਨਨਾਥਪੁਰੀ ਦੀ ਰਹੀ ਹੈ ਉੱਥੇ ਸਾਨੂੁੰ ਬਹੁਤ ਵਧੀਆ ਲੱਗਿਆ ਗੁਰੂ ਨਾਨਕ ਦੇਵ ਜੀ ਨੇ ਆਰਤੀ ਉਤਾਰੀ ਸੀ ਜਾ ਕੇ ਉੱਥੇ ਅਤੇ ਹੈ ਵੀ ਸਮੁੰਦਰ ਦੇ ਕੰਢੇ 'ਤੇ ਹੈ ਬਹੁਤ ਜ਼ਿਆਦਾ ਅੱਛਾ ਲੱਗਿਆ ਸਾਨੂੰ ਸਮੁੰਦਰ 'ਤੇ ਜਾ ਕੇ ਅਤੇ ਸੂਰਜ ਦਾ ਡੁੱਬਣਾ ਚੜ੍ਹਨਾ ਤਾਂ ਮੈਨੂੰ ਕੋਈ ਖਾਸ ਯਾਦ ਨਹੀਂ ਹੈ ਬਸ ਉਹ ਮੈਨੂੰ ਗੁਰਦੁਆਰਾ ਸਾਹਿਬ ਦੀ ਯਾਦ ਜ਼ਰੂਰ ਹੈਗੀ ਆ